ਸਾਲ ਭਰ ਵਿੱਚ ਵੱਖ ਵੱਖ ਮੌਸਮਾਂ ਦੇ ਵਿੱਚ ਸਾਡੇ ਖੇਤਰ ਦੇ ਵਿੱਚ ਦੋ ਫਸਲਾਂ ਤਿਆਰ ਕਰੀਆਂ ਜਾਂਦੀਆਂ ਨੇ ਕਈ ਜਗ੍ਹਾ ਤਿੰਨ ਤਿੰਨ ਵੀ ਕਰਦੇ ਹਨ ਅਸੀਂ ਗਰਮੀਆਂ ਦੇ ਵਿੱਚ ਜੀਰੀਆਂ ਲਾਉਂਦੇ ਹਾਂ ਝੋਨਾ ਵੀ ਕਹਿ ਦਿੰਦੇ ਹਾਂ ਓ ਉਹ ਫਸਲ ਨੂੰ ਅਤੇ ਸਰਦੀਆਂ ਦੇ ਵਿੱਚ ਕਣਕ ਬੀਜੀ ਜਾਂਦੀ ਹੈ ਕਣਕ ਦੇ ਨਾਲ ਗੇਹੂੰ ਤਿਆਰ ਜਿੱਦਾਂ ਕਹਿ ਦਿੰਦੇ ਵੀ ਉਹਦੇ ਵਿੱਚ ਆਟਾ ਤਿਆਰ ਕਰਿਆ ਜਾਂਦਾ ਅਤੇ ਸਾਲ ਭਰ ਉਸ ਫ਼ਸਲ ਜਿਹੜਾ ਦਾਣਾ ਤਿਆਰ ਕੀਤਾ ਜਾਂਦਾ ਹੈ ਉਸ ਨੂੰ ਅਲੱਗ ਅਲੱਗ ਖੇਤਰਾਂ ਦੇ ਵਿੱਚ ਭੇਜਿਆ ਜਾਂਦਾ ਹੈ ਪੰਜਾਬ ਸਭ ਤੋਂ ਵੱਡਾ ਇੱਧਰ ਜ ਸਥਾਨ ਹੈ ਜਿੱਥੋਂ ਇਹ ਚੀਜ਼ਾਂ ਦੀ ਭਰਪੂਰ ਮਾਤਰਾ ਦੇ ਵਿੱਚ ਉਸਾਰੀ ਹੁੰਦੀ ਹੈ ਅਤੇ ਦੂਜੇ ਨੰਬਰ ਹੁਣ ਉਸ ਤੋਂ ਬਾਅਦ ਸਰ ਆਪਣਾ ਗਰਮੀਆਂ ਦੇ ਵਿੱਚ ਇੱਕ ਮੱਕੀ ਵੀ ਤਿਆਰ ਕੀਤੀ ਜਾਂਦੀ ਹੈ ਮੱਕੀ ਦੀ ਫਸਲ ਵੀ ਤਿਆਰ ਕੀਤੀ ਜਾਂਦੀ ਹੈ ਕਈ ਲੋਕ ਮੱਕੀ ਤਿਆਰ ਕਰਵਾ ਕੇ ਮੱਕੀ ਦਾ ਆਚਾਰ ਤਿਆਰ ਕਰਵਾ ਕੇ ਪਸ਼ੂਆਂ ਦੇ ਲਈ ਵਰਤਦੇ ਹਨ ਅਤੇ ਮੱਕੀਆਂ ਨੂੰ ਪਕਾ ਕੇ ਉਸਦੇ ਦਾਣਿਆਂ ਨੂੰ ਵੀ ਤਿਆਰ ਕੀਤਾ ਜਾਂਦਾ ਉਸ ਦਾ ਵੀ ਆਟਾ ਬਣਾਇਆ ਜਾਂਦਾ ਹੈ ਅਤੇ ਉਸਦਾ ਬੇਸਣ ਆਪਣਾ ਅਤੇ ਛੋਲਿਆਂ ਨੂੰ ਵੀ ਕਈ ਲੋਕ ਬੀਜਦੇ ਹਨ ਕਈ ਕਈ ਤਰ੍ਹਾਂ ਦੀਆਂ ਅਤੇ ਇਸ ਤੋਂ ਬਾਅਦ ਛੋਲਿਆਂ ਤੋਂ ਬੇਸਣ ਤਿਆਰ ਕੀਤਾ ਜਾਂਦਾ ਹੈ ਅਤੇ ਸੇ ਸਰਦੀਆਂ ਦੇ ਵਿੱਚ ਕਣਕਾਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਉਹਨਾਂ ਦੇ ਵਿੱਚ ਕਈ ਲੋਕਾਂ ਨੂੰ ਉਸ ਚੀਜ਼ਾਂ ਦੇ ਕਰਨ ਦੇ ਵਿੱਚ ਬਹੁਤ ਵਧੀਆ ਰੁਝਾਨ ਹੈ ਅਤੇ ਜਿਸ ਦੇ ਨਾਲ ਉਹਨਾਂ ਦੀ ਫਸਲ ਦੇ ਵਿੱਚ ਪੈਦਾਵਾਰ ਚੰਗੀ ਹੁੰਦੀ ਹੈ ਅਤੇ ਜਿਸ ਦੇ ਨਾਲ ਉਹਨਾਂ ਨੂੰ ਮੁਨਾਫਾ ਵੀ ਚੰਗਾ ਹੁੰਦਾ ਹੈ